ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਵਿੰਦਰ ਸਿੰਘ ਜੀ ਬੋਲਦੇ ਹੋ ਅੱਛਾ ਹਾਂਜੀ ਵੀਰ ਜੀ ਉਹ ਅਸੀਂ ਤੁਹਾਡੇ ਨਵੇਂ ਕਿਰਾਏਦਾਰ ਬੋਲਦੇ ਹਾਂ ਜਿਹੜੇ ਨਵੇਂ ਅਪਾਰਟਮੈਂਟ 'ਚ ਆਏ ਹਾਂ ਫਲੈਟ ਨੰਬਰ ਹੈਗਾ ਜੀ ਚਾਰ ਸੌ ਦੋ ਹਾਂਜੀ ਚਾਰ ਸੌ ਦੋ ਹੀ ਆ ਅਤੇ ਅਸੀਂ ਤੁਹਾਨੂੰ ਪੁੱਛਣਾ ਸੀ ਵੀ ਬਿਜਲੀ ਦਾ ਬਿੱਲ ਕਿੰਨਾ ਕੁ ਆ ਜਾਂਦਾ ਜੀ ਇੱਥੇ ਕਿਉਂਕਿ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਗਾ ਵੀ ਕਿੰਨਾ ਕ ਆਉਂਦਾ ਅੱਛਾ ਜੀ ਇੰਨਾਂ ਬਿਜਲੀ ਦਾ ਬਿੱਲ ਆਉਂਦਾ ਸਾਨੂੰ ਤਾਂ ਪਤਾ ਹੀ ਨਹੀਂ ਵੀ ਇੰਨਾਂ ਆਜੂ ਸਾਡੇ ਕੋਲ ਤਾਂ ਫਿਰ ਕਾਫੀ ਕੁਛ ਆ ਸ ਸਾਡੇ ਕੋਲ ਗੀਜ਼ਰ ਵੀ ਆ ਫਰਿਜ ਵੀ ਆ ਇੰਡਕਸ਼ਨ ਚੁੱਲ੍ਹਾ ਵੀ ਆ ਹੋਰ ਕਾਫੀ ਸਮਾਨ ਹੈਗਾ ਤੁਸੀਂ ਸਾਨੂੰ ਫਿਰ ਪਹਿਲਾਂ ਦੱਸਣਾ ਸੀ ਵੀ ਇੰਨਾਂ ਬਿਜਲੀ ਦਾ ਬਿਲ ਆਵੇਗਾ ਅਸੀਂ ਚਲੋ ਸਮਾਨ ਨਾ ਲੈਂਦੇ ਜੋ ਅਸੀਂ ਸਾਡਾ ਘੱਟ ਕਰ ਆਉਂਦੇ ਇਹ ਤਾਂ ਬਹੁਤ ਜ਼ਿਆਦਾ ਗਾ ਸਮਾਨ ਸਾਡਾ ਅੱਛਾ ਚਲੋ ਕੋਈ ਨਾ ਵੀਰ ਜੀ ਫਿਰ ਅਸੀਂ ਬਿਜਲੀ ਬੋਰਡ ਵਾਲਿਆਂ ਨਾਲ ਗੱਲ ਕਰਕੇ ਦੇਖ ਲੈਂਦੇ ਜੀ ਵੀ ਕੀ ਕਹਿੰਦੇ ਨੇ ਅੱਛਾ ਜੀ ਚਲੋ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਹੈ ਹੈਲੋ ਹਾਂਜੀ ਬਿਜਲੀ ਬੋਰਡ ਦਫਤਰ 'ਚੋਂ ਬੋਲਦੇ ਹੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਸੁਖਵਿੰਦਰ ਸਿੰਘ ਜੀ ਐਸਡੀਓ ਬੋਲਦੇ ਹੋ ਹਾਂਜੀ ਉਹ ਅਸੀਂ ਬਿਜਲੀ ਬਾਰੇ ਪੁੱਛਣਾ ਸੀ ਵੀ ਬਿਜਲੀ ਦਾ ਬਿਲ ਕਿੰਨਾ ਕੁ ਆ ਜਾਂਦਾ ਮਤਲਬ ਕਿੰਨੀ ਕੁ ਯੂਨਿਟ ਮੱਚਦੀ ਹੈ ਦਿਨ 'ਚ ਜਾਂ ਹਫਤੇ ਦਸ ਦਿਨ ਦੀ ਕਿਉਂਕਿ ਸਾਨੂੰ ਤਾਂ ਕੁਛ ਪਤਾ ਨਹੀਂ ਇਸ ਬਾਰੇ ਜਿੱਥੇ ਅਸੀਂ ਪਹਿਲਾਂ ਸੀ ਮੰਨ ਲਓ ਉੱਥੇ ਤਾਂ ਕਾਫੀ ਠੀਕ ਬਿੱਲ ਆਉਂਦਾ ਸੀ ਸਾਨੂੰ ਜੀਰੋ ਮਾਈਨਸ 'ਚ ਹੀ ਆਉਂਦਾ ਸੀਗਾ ਅਤੇ ਹੁਣ ਸਾਨੂੰ ਅਸੀਂ ਇੱਥੇ ਨਵੇਂ ਆਏ ਹਾਂ ਚਾਰ ਸੌ ਦੋ 'ਚ ਅਤੇ ਸਾਨੂੰ ਇਸਦਾ ਪਤਾ ਨਹੀਂ ਵੀ ਕਿੰਨਾ ਕੁ ਬਿੱਲ ਆਵੇਗਾ ਸਾਡੇ ਕੋਲ ਕਾਫੀ ਕੁਝ ਸਮਾਨ ਹੈਗਾ ਇੰਡਕਸ਼ਨ ਚੁੱਲ੍ਹਾ ਗਾ ਗੀਜਰ ਆ ਫਰਿਜ ਆ ਇੱਕ ਵੀਰ ਜੀ ਸਾਨੂੰ ਐਂ ਦੱਸ ਦਿਓ ਵੀ ਕਿੰਨੀ ਯੂਨਿਟ ਮਾਫ ਹੁੰਦੀ ਹੈਗੀ ਇੱਥੇ ਕਿਉਂਕਿ ਸਾਨੂੰ ਇੰਨਾਂ ਨਵੇਂ ਸ਼ਹਿਰ 'ਚ ਆਉਣ ਕਰਕੇ ਨਵੇਂ ਅਪਾਰਟਮੈਂਟ ਸਾਨੂੰ ਇੰਨਾਂ ਪਤਾ ਨਹੀਂ ਗਾ ਹਾਂਜੀ ਅੱਛਾ ਜੀ ਚਲੋ ਠੀਕ ਆ ਵੀਰ ਜੀ ਕੋਈ ਨਾ ਫਿਰ ਸਾਨੂੰ ਦੱਸ ਦਿਓ ਜਾਂ ਕੋਈ ਬੰਦਾ ਭੇਜ ਦਿਓ ਠੀਕ ਹੈ ਵੀਰ ਜੀ ਧੰਨਵਾਦ